ਮੇਰਾ ਪਿੰਡ ਹੰਡਿਆਇਆ ਹੈ ਇਹ ਸਾਫ ਸੁਥਰਾ ਅਤੇ ਖੁਸ਼ਹਾਲ ਪਿੰਡ ਹੈ ਮੇਰੇ ਪਿੰਡ ਵਿੱਚ ਬਹੁਤ ਘੱਟ ਹੁੰਦੇ ਹਨ ਜੇਕਰ ਕੋਈ ਲੜਾਈ ਹੋ ਵੀ ਜਾਂਦੀ ਹੈ ਉਸਨੂੰ ਸਾਡੇ ਪਿੰਡ ਦਾ ਸਰਪੰਚ ਅਤੇ ਮੈਂਬਰ ਮਿਲ ਕੇ ਹੱਲ ਕਰਦੇ ਹਨ ਮੈਂ ਤੁਹਾਨੂੰ ਮੇਰੇ ਪਿੰਡ ਦੀ ਲੜਾਈ ਦਾ ਹੱਲ ਇੰਝ ਦੱਸ ਸਕਦਾ ਹਾਂ ਜਿਵੇਂ ਕਿ ਸਾਡੇ ਗੁਆਂਢ ਵਿੱਚ ਲੜਾਈ ਹੋਈ ਸੀ ਜ਼ਮੀਨ ਦੀ ਜੋ ਕਿ ਉਸਦੇ ਵੱਡੇ ਭਰਾ ਨੂੰ ਆਉਂਦੀ ਸੀ ਅਤੇ ਉਹ ਮਿਹਨਤ ਬਹੁਤ ਕਰਦਾ ਸੀ ਖੇਤਾਂ ਵਿੱਚ ਹੱਲ ਵਾਉਂਦਾ ਸੀ ਸਬਜ਼ੀਆਂ ਬੀਜਦਾ ਸੀ ਝੋਨਾ ਲਾਉਂਦਾ ਸੀ ਕਣਕ ਲਾਉਂਦਾ ਸੀ ਅਤੇ ਉਸਦਾ ਛੋਟਾ ਭਰਾ ਬਹੁਤ ਹੀ ਆਲਸੀ ਸੀ ਕਿ ਨਸ਼ੇ ਵਗੈਰਾ ਕਰਦਾ ਸੀ ਅਤੇ ਉਹ ਆਪਣੇ ਭਰਾ ਦੀ ਜ਼ਮੀਨ 'ਤੇ ਆਪਣਾ ਹੱਕ ਜਤਾ ਰਿਹਾ ਸੀ ਵੱਡਾ ਭਰਾ ਉਸਨੂੰ ਮਿਹਨਤ ਕਰਨ ਲਈ ਕਹਿੰਦਾ ਪੜ੍ਹਾਈ ਕਰਨ ਲਈ ਕਹਿੰਦਾ ਉਸਦਾ ਉਸਦੇ ਖੇਤਾਂ ਵਿੱਚ ਹੱਥ ਵਟਾਉਣ ਲਈ ਕਹਿੰਦਾ ਪਰ ਉਹ ਨਹੀਂ ਸੁਣਦਾ ਸੀ ਉਹ ਸਾਰਾ ਦਿਨ ਸੋਂਦਾ ਰਹਿੰਦਾ ਗੀਤ ਗਾਉਂਦਾ ਰਹਿੰਦਾ ਲੜਾਈਆਂ ਕਰਦਾ ਰਹਿੰਦਾ ਤਾਂ ਉਹ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਤਪਾ ਕੇ ਰੱਖਦਾ ਸੀ ਪਰ ਉਹ ਇੱਕ ਨਹੀਂ ਸੁਣਦਾ ਸੀ ਇੱਕ ਦਿਨ ਉਹ ਨਸ਼ੇ ਕਰਕੇ ਘਰ ਆਇਆ ਅਤੇ ਉਸਦੇ ਵੱਡਾ ਭਰਾ ਨਾਲ ਲੜਨ ਲੱਗ ਪਿਆ ਉਸਦਾ ਵੱਡਾ ਭਰਾ ਉਸਨੂੰ ਸਮਝਾ ਰਿਹਾ ਸੀ ਕਿ ਤੂੰ ਛੋਟੇ ਵੀਰ ਨਸ਼ੇ ਨਾ ਕਰ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਅਤੇ ਵੱਡਾ ਅਫਸਰ ਬਣ ਅਤੇ ਉਸਨੂੰ ਇੰਝ ਲੱਗਿਆ ਕਿ ਉਸਦਾ ਵੱਡਾ ਭਰਾ ਉਸਦੀ ਨਾਲ ਧੱਕਾ ਕਰ ਹੈ ਪਰ ਅਜਿਹਾ ਨਹੀਂ ਸੀ ਉਸਦਾ ਵੱਡਾ ਭਰਾ ਉਸਨੂੰ ਬਹੁਤ ਹੀ ਲਾਡ ਪਿਆਰ ਨਾਲ ਰੱਖਦਾ ਸੀ ਉਹ ਨਸ਼ੇ ਦੀ ਹਾਲਤ ਵਿੱਚ ਆਪਣੇ ਭਰਾ ਦੇ ਉੱਤੇ ਹਮਲਾ ਕਰ ਦਿੰਦਾ ਹੈ ਅਤੇ ਜਿਹਦੇ ਨਾਲ ਉਹਦੇ ਭਰਾ ਦਾ ਸਿਰ ਪਟ ਜਾਂਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਵਿੱਚ ਲੜਾਈ ਹੋ ਜਾਂਦੀ ਹੈ ਜਿਸ ਕਰਕੇ ਉਸਦਾ ਵੱਡਾ ਭਰਾ ਪੰਚਾਇਤ ਵਿੱਚ ਚਲਾ ਜਾਂਦਾ ਹੈ ਅਤੇ ਪੰਚਾਇਤ ਦੇ ਮੈਂਬਰ ਨੂੰ ਕਹਿੰਦਾ ਹੈ ਕਿ ਉਸਦਾ ਹੱਲ ਕਰਵਾਇਆ ਜਾਏ ਤਾਂ ਜੋ ਉਸਦੀ ਇਹ ਨਿੱਜੀ ਮਾਮਲਾ ਨਾ ਸੁਲਝ ਸਕਿਆ ਤਾਂ ਉਸਨੇ ਇਸ ਤਰ੍ਹਾਂ ਆਪਣੇ ਪੰਚਾਇਤ ਦੇ ਸਰਪੰਚ ਨੂੰ ਬੁਲਾ ਕੇ ਪਿੰਡ ਵਿੱਚ ਸੱਥ ਵਿੱਚ ਖੜ੍ਹਾ ਕਰਕੇ ਉਸਦੇ ਭਰਾ ਨੂੰ ਸਜ਼ਾ ਦਵਾ ਤੀ ਅਤੇ ਉਸ ਨਾਲ ਆਪਣਾ ਨਿੱਜੀ ਮਾਮਲਾ ਸੀ ਜੋ ਵੀ ਇਸਦਾ ਹੱਲ ਕਰਵਾਇਆ ਅਤੇ ਇਸ ਵਿੱਚ ਉਸਦਾ ਵੱਡਾ ਭਰਾ ਹੱਕਦਾਰ ਰਿਹਾ ਜ਼ਮੀਨ ਦਾ